ਟੈਕਨੋਲਜੀ ਅੱਜ ਦੇ ਜ਼ਮਾਨੇ ਵਿੱਚ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਚੀਜ਼ ਹੈ ਅਤੇ ਇਸ ਨੇ ਹੁਣ ਦੀ ਪੀੜ੍ਹੀ ਨੂੰ ਹੁਣ ਦੀ ਤਾਂ ਛੱਡੀਏ ਇਸਨੇ ਸਾਡੇ ਤੋਂ ਪਹਿਲਾਂ ਵਾਲੇ ਦੀ ਪੀੜ੍ਹੀ ਨੂੰ ਵੀ ਆਪਣੇ ਪੂਰੇ ਕਬਜ਼ੇ ਵਿੱਚ ਕਰ ਲਿਆ ਹੈ ਟੈਕਨੋਲਜੀ ਰਾਹੀਂ ਹੁਣ ਜਿਵੇਂ ਕਈ ਸੋਫਟਵੇਅਰ ਹਨ ਫੇ ਫੇਸਬੁੱਕ ਵਟਸਐਪ ਇੰਸਟਾਗਰਾਮ ਅਸੀਂ ਕਿਸੇ ਵੀ ਕੋਨੇ 'ਚ ਬੈਠੇ ਦੁਨੀਆ ਦੇ ਕਿਸੇ ਵੀ ਕੋਨੇ 'ਚ ਦੂਸਰੇ ਬੰਦੇ ਨਾਲ ਸੰਪਰਕ ਕਰ ਸਕਦੇ ਹਾਂ ਇਸ ਤਰ੍ਹਾਂ ਕਈ ਕਈ ਵਾਰ ਤਾਂ ਤੁਸੀਂ ਅਣਜਾਣ ਵਿਅਕਤੀ ਦੇ ਵੀ ਟੈਕਨੋਲੋਜੀ ਰਾਹੀਂ ਇੰਨੇ ਚੰਗੇ ਦੋਸਤ ਬਣ ਜਾਂਦੇ ਹੋ ਜਿੰਨਾਂ ਤੁਸੀਂ ਆਪਣੇ ਕਿਸੇ ਹੋਰ ਦੋਸਤ ਦੇ ਨਹੀਂ ਬਣਦੇ ਅਤੇ ਇਸ ਲੀਏ ਟੈਕਨੋਲਜੀ ਨੇ ਸਾਨੂੰ ਇਸ ਵਿੱਚ ਕਈ ਤਰ੍ਹਾਂ ਦੇ ਲਾਭ ਵੀ ਦਿੱਤੇ ਹਨ ਅਤੇ ਕਈ ਤਰ੍ਹਾਂ ਨੁਕਸਾਨ ਵੀ ਦਿੱਤੇ ਹਨ ਕਈ ਲੋਕ ਹੁਣ ਮੈਸੇਜ ਕਰਕੇ ਸਾ ਦੂਜੇ ਲੋਕਾਂ ਨੂੰ ਠੱਗ ਲੈਂਦੇ ਹਨ ਬਟ ਜੋ ਕਿ ਚੰਗੀ ਗੱਲ ਨਹੀਂ ਹੈ ਅਤੇ ਇਸ ਲੀਏ ਉਹ ਬਹੁਤ ਹੀ ਜ਼ਿਆਦਾ ਫਰੋਡ ਦਾ ਸ਼ਿਕਾਰ ਹੁੰਦੇ ਹਨ ਪਰ ਦੂਜੇ ਪਾਸੇ ਅਸੀਂ ਕਿਸੇ ਵੀ ਆਪਣੇ ਪੁਰਾਣੇ ਮਿੱਤਰ ਨੂੰ ਜਿਹਨੂੰ ਅਸੀਂ ਬਹੁਤ ਟਾਈਮ ਤੋਂ ਨਹੀਂ ਮਿਲੇ ਅਸੀਂ ਉਹਨਾਂ ਆਰਾਮ ਨਾਲ ਉਹਨੂੰ ਵੀਡੀਓ ਕਾਲ ਕਰਕੇ ਉਹਦੇ ਨਾਲ ਆਨੰਦ ਮਾਣ ਸਕਦੇ ਹਾਂ ਗੱਲਾਂ ਦਾ ਅਤੇ ਇਸ ਤਰ੍ਹਾਂ ਇਹ ਚੀਜ਼ਾਂ ਸਾਨੂੰ ਲਾਭ ਵੀ ਦਿੰਦੀਆਂ ਹਨ ਅਤੇ ਨੁਕਸਾਨ ਵੀ ਧੰਨਵਾਦ